ਮੇਰਾ ਨਾਮ ਮੋਨਿਕਾ ਰਾਣੀ ਹੈ ਅਸੀਂ ਪਿੰਡ ਰੈਲ ਮਾਜਰੇ ਵਿੱਚ ਰਹਿੰਦੇ ਹਨ ਅਸੀਂ ਸਾਰਿਆਂ ਨੇ ਮੋਹਾਲੀ ਘੁੰਮਣ ਜਾਣਾ ਸੀ ਅਤੇ ਮੈਂ ਆਪਣੇ ਜਾਣ ਪਹਿਚਾਣ ਦੇ ਬੰਦੇ ਨੂੰ ਕਿਹਾ ਕਿ ਅਸੀਂ ਮੋਹਾਲੀ ਘੁੰਮਣ ਜਾਣਾ ਸਾਨੂੰ ਦੋ ਤਿੰਨ ਦਿਨ ਪਹਿਲਾਂ ਟੈਕਸੀ ਬੁੱਕ ਕਰਵਾ ਕੇ ਦਿੱਤੀ ਜਾਵੇ ਉਸ ਨੇ ਸਾਨੂੰ ਟੈਕਸੀ ਬੁੱਕ ਵੀ ਕਰਵਾ ਕੇ ਦੇ ਦਿੱਤੀ ਅਤੇ ਅਸੀਂ ਸਾਰੇ ਜਾਣੇ ਪੈਕਿੰਗ ਪੂਕਿੰਗ ਕਰਕੇ ਚੱਲੇ ਹੀ ਸਨ ਅਤੇ ਸਾਨੂੰ ਫੋਨ ਆਇਆ ਕਿ ਸਾਡੀ ਚਾਚੀ ਜੀ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ ਉਹਨਾਂ ਦੀ ਸਿਹਤ ਬਹੁਤ ਖਰਾਬ ਹੈ ਇਸ ਕਰਕੇ ਅਸੀਂ ਮੋਹਾਲੀ ਨਹੀਂ ਜਾ ਸਕੇ ਅਸੀਂ ਜਿਸ ਤੋਂ ਕਿਹਾ ਹੈ ਸਾਡੀ ਟੈਕਸੀ ਬੁੱਕ ਕਰਵਾ ਦੇ ਅਸੀਂ ਉਸ ਨੂੰ ਐਪਲੀਕੇਸ਼ਨ ਲਿਖ ਕੇ ਦਿੱਤੀ ਕਿ ਸਾਨੂੰ ਸਾਡੇ ਪੈ ਪੈਸੇ ਵਾਪਸ ਕਰਵਾ ਦਿੱਤੇ ਜਾਵੇ ਕਿਉਂਕਿ ਸਾਡਾ ਪ੍ਰੋਗਰਾਮ ਕੈਂਸਲ ਹੋ ਗਿਆ ਹੈ ਸਾਨੂੰ ਦੋ ਜਾਂ ਤਿੰਨ ਦਿਨਾਂ ਵਿੱਚ ਪੈਸੇ ਵਾਪਸ ਕੀਤੇ ਜਾਵੇ